ਹਾਂਜੀ ਮੈਂ ਇੱਕ ਬੋਲਣ ਵਾਲਾ ਪੰਛੀ ਵੇਖਿਆ ਸੀ ਅਤੇ ਉਹ ਇੱਕ ਤੋਤਾ ਸੀਗਾ ਜਿਹੜਾ ਸਾਡੇ ਲਾਗੇ ਇੱਕ ਜਿਹੜੇ ਹੈਗੇ ਨੇ ਪੰਡਿਤ ਜੀ ਰਹਿੰਦੇ ਹੁੰਦੇ ਸੀਗੇ ਉਹਨਾਂ ਨੇ ਪਾਲਿਆ ਹੋਇਆ ਸੀ ਉਹਨਾਂ ਨੂੰ ਪੰਛੀਆਂ ਦਾ ਕਾਫ਼ੀ ਸ਼ੌਂਕ ਸੀਗਾ ਉਹ ਤੋਤਾ ਜਿਹੜਾ ਸੀਗਾ ਉਹ ਬੋਲ ਸਕਦਾ ਸੀਗਾ ਹਾਲਾਂਕਿ ਛੋਟੇ ਛੋਟੇ ਸ਼ਬਦ ਸੀਗੇ ਪਰ ਪੰਡਿਤ ਜੀ ਨੇ ਉਹਨਾਂ ਨੂੰ ਬੜਾ ਸੋਹਣਾ ਸਿਖਾਇਆ ਹੋਇਆ ਸੀਗਾ ਅਤੇ ਉਹ ਪੰਜਾਬੀ ਦੇ ਵਿੱਚ ਹੀ ਉਹਨਾਂ ਨੂੰ ਸਿਖਾਇਆ ਹੋਇਆ ਸੀਗਾ ਤੇ ਕਿਉਂਕਿ ਪੰਡਿਤ ਜੀ ਸੀਗੇ ਘਰ ਦੇ ਵਿੱਚ ਰੱਬ ਦਾ ਨਾਮ ਰੂਟੀਨ ਦੇ ਵਿੱਚ ਲਿਆ ਜਾਂਦਾ ਸੀਗਾ ਅਤੇ ਪੰਡਿਤ ਜੀ ਨੇ ਉਹਨਾਂ ਨੂੰ ਜਿਹੜਾ ਹੈਗਾ ਰਾਮ ਸ਼ਬਦ ਜਿਹੜਾ ਹੈਗਾ ਬੜਾ ਸੋਹਣਾ ਸਿਖਾਇਆ ਹੋਇਆ ਸੀ ਰਾਮ ਸ਼ਬਦ ਉਹ ਬੋਲ ਲੈਂਦਾ ਸੀਗਾ ਰਾਮ ਸਾਡੇ ਵਿਗੜੇ ਕੰਮ ਸਵਾਰਦੇ ਅਤੇ ਨਾਲ ਉਹ ਇਹ ਲਾਈਨ ਵੀ ਕਈ ਵਾਰ ਬੋਲ ਲੈਂਦਾ ਹੁੰਦਾ ਸੀਗਾ ਬੜਾ ਹੀ ਵਧੀਆ ਲ ਜਦੋਂ ਅਸੀਂ ਕਿਸੇ ਪੰਛੀ ਨੂੰ ਬੋਲਦਿਆਂ ਵੇਖਦੇ ਹੈਗੇ ਹਾਂ ਤਾਂ ਬੜਾ ਹੀ ਅ ਆਨੰਦ ਆਉਂਦਾ ਹੈਗਾ ਆ ਵਧੀਆ ਲੱਗਦਾ ਹੈਗਾ ਵੀ ਇੱਕ ਜਿਹੜਾ ਜਾਨਵਰ ਹੈਗਾ ਬੋਲ ਪਾ ਰਿਹਾ ਹੈਗਾ ਆ ਹਾਲਾਂਕਿ ਇਨਸਾਨਾਂ ਵਾਂਗੂੰ ਨਾ ਸਹੀ ਪਰ ਇੱਕ ਜਾਨਵਰ ਦੇ ਮੂੰਹ ਦੇ ਵਿੱਚੋਂ ਇਨਸਾਨੀ ਭਾਸ਼ਾ ਸੁਣਨੀ ਬੜੀ ਹੀ ਮਨ ਨੂੰ ਜਿਹੜੀ ਹੈਗੀ ਹੈ ਸਕੂਨ ਜਿਹਾ ਦਿੰਦੀ ਹੈਗੀ ਆ ਔਰ ਖ਼ਾਸ ਕਰਕੇ ਜਦੋਂ ਉਸ ਪੰਛੀ ਦਾ ਜਿਹੜਾ ਮਾਲਕ ਹੈਗਾ ਆ ਉਹਨੇ ਉਹਨੂੰ ਜਿਹੜਾ ਹੈਗਾ ਰੱਬ ਦੇ ਕਿਸੇ ਨੂੰ ਗਲਤ ਬੋਲਣਾ ਨਹੀਂ ਸਿਰਫ਼ ਰੱਬ ਦਾ ਨਾਮ ਹੀ ਸਿਖਾਇਆ ਹੋਵੇ ਔਰ ਉਸ ਚੀਜ਼ ਜਿਹੜੀ ਹੈਗੀ ਆ ਉਹ ਮਨ ਨੂੰ ਖੁਸ਼ੀ ਵੀ ਦਿੰਦੀ ਹੈਗੀ ਆ ਅਤੇ ਵਧੀਆ ਵੀ ਲੱਗਦਾ ਹੈਗਾ ਆ ਵੀ ਇੱਕ ਪੰਛੀ ਵੀ ਜਿਹੜਾ ਹੈਗਾ ਰੱਬ ਦਾ ਨਾਮ ਲੈ ਰਿਹਾ ਹੈਗਾ ਧੰਨਵਾਦ ਜੀ